ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਪ੍ਰੀਤ ਸਿੰਘ ਗੱਲ ਕਰ ਰਿਹਾ ਤਰਨ ਤਰਨ ਤੋਂ ਮੈਂ ਔਨਲਾਈਨ ਪਰਚੇਸ ਕੀਤੀ ਸੀ ਇਲੈਕਟ੍ਰੋਨਿਕ ਮੋਬਾਈਲ ਫੋਨ ਦੀ ਮੋਬਾਈਲ ਫੋਨ ਬਹੁਤ ਹੀ ਵਧੀਆ ਸੀ ਮੈਂ ਸੈਮਸੰਗ ਕੰਪਨੀ ਦਾ ਲਿੱਤਾ ਸੀ ਐਫ ਬਾਰਾਂ ਮੋਡਲ ਮੋਬਾਈਲ ਫੋਨ ਬਹੁਤ ਹੀ ਵਧੀਆ ਸੀ ਪੈਕਜਿੰਗ ਵੀ ਬਹੁਤ ਹੀ ਵਧੀਆ ਸੀ ਅਤੇ ਮੈਨੂੰ ਪ੍ਰਾਈਜ਼ ਵੀ ਮਾਰਕੀਟ ਨਾਲੋਂ ਕਾਫੀ ਘੱਟ ਰੇਟ 'ਤੇ ਮਿਲਿਆ ਅਤੇ ਡਿਲੀਵਰੀ ਵੀ ਬਹੁਤ ਜਲਦੀ ਹੋ ਗਈ ਸੀ ਅਤੇ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੋਬਾਇਲ ਫੋਨ ਲੈਣ ਦਾ ਮੈਨੂੰ ਅਸੈਸਰੀ ਵੀ ਨਾਲ ਗਿਫਟ ਦੇ ਤੌਰ 'ਤੇ ਭੇਜੀ ਗਈ ਚਾਰਜਰ ਹੈਡਫੋਨ ਗਾਰਡ ਕਵਰ ਸਾਰਾ ਕੁਛ ਮੈਨੂੰ ਗਿਫਟ ਦੇ ਤੌਰ 'ਤੇ ਭੇਜਿਆ ਗਿਆ ਸਰਵਿਸ ਮੈਨੂੰ ਬਹੁਤ ਹੀ ਵਧੀਆ ਲੱਗੀ ਪੈਕਜਿੰਗ ਵੀ ਬਹੁਤ ਵਧੀਆ ਸੀ ਮੋਬਾਇਲ ਮੈਨੂੰ ਦੋ ਦਿਨ ਦੇ ਵਿੱਚ ਵਿੱਚ ਡਿਲੀਵਰ ਹੋ ਗਿਆ ਅਤੇ ਮੈਨੂੰ ਆਪਣੇ ਕ੍ਰੈਡਿਟ ਕਾਰਡ ਤੋਂ ਫਾਈਨੈਂਸ ਕਰਵਾਉਣ 'ਤੇ ਵੀ ਬਹੁਤ ਵਧੀਆ ਔਫਰ ਮਿਲੀ ਅਤੇ ਮੈਨੂੰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੁਹਾਡੇ ਨਾਲ ਮੈਂ ਅੱਗੇ ਵੀ ਔਡਰ ਕਰਦਾ ਰਹਾਂਗਾ ਇਸ ਔਡਰ ਲਈ ਮੈਂ ਤੁਹਾਡਾ ਬਹੁਤ ਠੈਂਕਫੁੱਲ ਹੈ ਜੀ ਬਹੁਤ ਬਹੁਤ ਧੰਨਵਾਦ